ਸਾਡੇ ਜ਼ਿਲ੍ਹੇ ਫਾਜ਼ਿਲਕਾ ਵਿੱਚ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਾਰੇ ਸਫਾਈ ਕਰਮਚਾਰੀ ਆਪੋ ਆਪਣਾ ਕੰਮ ਧਿਆਨ ਨਾਲ ਵੇਖ ਰੇਖ ਕਰਕੇ ਚੰਗੀ ਤਰ੍ਹਾਂ ਕਰਨ ਉਹਨਾਂ ਨੂੰ ਚਾਹੀਦਾ ਹੈ ਕਿ ਫਾਜ਼ਿਲਕਾ ਦੀਆਂ ਗਲੀਆਂ ਅਤੇ ਸੜਕਾਂ ਵਿੱਚੋਂ ਕੂੜਾ ਕਰਕਟ ਰੋਜ਼ਾਨਾ ਲੈ ਕੇ ਜਾਇਆ ਜਾਵੇ ਕਈ ਸਫਾਈ ਕਰਮਚਾਰੀ ਨਾਗੇ ਪਾ ਦਿੰਦੇ ਹਨ ਕਿਉਂਕਿ ਉਹਨਾਂ ਦੇ ਦਿਲ ਵਿੱਚ ਇਹ ਹੁੰਦਾ ਹੈ ਕਿ ਸਾਨੂੰ ਕਿਹੜਾ ਪ੍ਰਸ਼ਾਸਨ ਦੇਖ ਰਿਹਾ ਹੈ ਇਸ ਵਿੱਚ ਜਿਹੜੇ ਆਮ ਲੋਕ ਹੁੰਦੇ ਹਨ ਉਹਨਾਂ ਦੇ ਘਰਾਂ ਵਿੱਚ ਕੂੜਾ ਕਰਕਟ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਸਫਾਈ ਕਰਮਚਾਰੀਆਂ ਨੂੰ ਯਾਨੀ ਕਿ ਦੇਖਣਾ ਚਾਹੀਦਾ ਹੈ ਕਿ ਅਸੀਂ ਆਪਣਾ ਕੰਮ ਸਲੀਕੇ ਨਾਲ ਰੋਜ਼ਮੱਰਾ ਚੰਗੀ ਤਰ੍ਹਾਂ ਕੂੜਾ ਕਰਕਟ ਉਹਨਾਂ ਦੇ ਘਰੋਂ ਲੈ ਕੇ ਜਾਈਏ ਅਤੇ ਸੜਕਾਂ ਵਿੱਚ ਝਾੜੂ ਮਾਰੀਏ ਸੜਕਾਂ ਅਤੇ ਗਲੀਆਂ ਨੂੰ ਸਾਫ ਰੱਖੀਏ ਅਤੇ ਜਿਸ ਨਾਲ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਪਨਾ ਵੀ ਸਾਕਾਰ ਹੋ ਸਕੇ ਜੋ ਕਿ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਸਵੱਛ ਭਾਰਤ ਅਭਿਆਨ ਉਹਦੇ 'ਤੇ ਆਪਾਂ ਅੱਗੇ ਵੱਧ ਸਕੀਏ ਆ ਅਤੇ ਆਪਾਂ ਆਪਣੇ ਭਾਰਤ ਨੂੰ ਖੁਸ਼ਹਾਲ ਅਤੇ ਸਮ੍ਰਿਧ ਬਣਾ ਸਕੀਏ ਜਿਸ ਨਾਲ ਰਾਸ਼ਟਰ ਪਿਤਾ ਸ੍ਰੀ ਮਹਾਤਮਾ ਗਾਂਧੀ ਜੀ ਦਾ ਸਪਨਾ ਵੀ ਸਾਕਾਰ ਹੋ ਸਕੇਗਾ